ਹਾਂਜੀ ਦੋਸਤੋ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਆਪਣੇ ਐਮਾਜ਼ੋਨ ਤੋਂ ਮੈਂ ਆਰਡਰ ਕੀਤਾ ਸੀ ਇੱਕ ਬੈਗ ਜਿਹੜਾ ਕਿ ਮੈਂ ਵਰਤਿਆ ਉਸ ਦਾ ਇੱਕ ਰੀਵਿਊ ਤੁਹਾਨੂੰ ਪੇਸ਼ ਕਰਨ ਜਾ ਰਹੀ ਹਾਂ ਇਹ ਬੈਗ ਬਹੁਤ ਹੀ ਜ਼ਿਆਦਾ ਮੈਨੂੰ ਨਿਰਾਸ਼ਾਜਨਕ ਲੱਗਿਆ ਕਿਉਂਕਿ ਇਸ ਦੇ ਵਿੱਚ ਇੱਕ ਵੀ ਚੀਜ਼ ਨਾ ਹੀ ਇਹਦੀ ਕੁਆਲਿਟੀ ਚੰਗੀ ਸੀ ਨਾ ਇਸ ਦਾ ਮਤਲਬ ਲੈਦਰ ਵੀ ਬਹੁਤ ਜ਼ਿਆਦਾ ਦੇਖਣ ਨੂੰ ਹੀ ਬੇਕਾਰ ਲੱਗਦਾ ਸੀ ਔਰ ਇਸ ਦੀਆਂ ਜ਼ਿੱਪਾਂ ਦਾ ਤਾਂ ਬਹੁਤ ਜ਼ਿਆਦਾ ਅਟਕ ਰਹੀਆਂ ਸਨ ਇਹ ਹੁਣ ਤਾਂ ਉਹਦੇ ਵਿੱਚੋਂ ਦੋ ਟੁੱਟ ਵੀ ਗਈਆਂ ਨੇ ਅਤੇ ਬਿਲਕੁਲ ਇਸ ਦੀ ਕੁਆਲਿਟੀ ਵ ਘਟੀਆ ਸੀ ਜੀ